ਹਾਂ ਹਰਬੰਸ ਸਿੰਘ ਡਾਇਰੀ ਤੋਂ ਬੋਲਦੇ ਆ ਜੀ ਅੱਛਾ ਦੁੱਧ ਦੱਧ ਦਾ ਚਾਹੀਦਾ ਸੀਗਾ ਜੀ ਥੋੜ੍ਹਾ ਜਿਹਾ ਬੱਚੇ ਆਏ ਹੋਏ ਆ ਫਿਰ ਖੋਆ ਖੂਆ ਮਾਰ ਦੇਈਏ ਅਤੇ ਜਰਾ ਕੁ ਅੱਛਾ ਮਿਲ ਜੇਗਾ ਨਾ ਕੋਈ ਮਿਲਾਵਟ ਅੱਜ ਕੱਲ੍ਹ ਅੱਜ ਕੱਲ੍ਹ ਤੁਹਾਨੂੰ ਪਤਾ ਨਾ ਵੀ ਮਿਲਾਵਟ ਖੋਰੀ ਇੱਕ ਅਲਾਮਤ ਬਣ ਚੁੱਕੀ ਹੈ ਇਹ ਇਹ ਦੋਸ਼ ਬਣ ਚੁੱਕਿਆ ਸਮਾਜ ਦਾ ਮਿਲਾਵਟ ਕਰਨੀ ਸੋ ਉਮੀਦ ਕਰਦੇ ਹਾਂ ਤੁਹਾਡੇ ਕੋਲੋਂ ਸਾਫ ਠੀਕ ਹੈ ਜੀ ਚਲੋ ਕੋਈ ਰੇਟ ਰੂਟ ਦੀ ਕੋਈ ਗੱਲ ਨਹੀਂ ਜਰਾ ਕੁ ਬਸ ਉਹ ਮਿਲ ਸਾਫ ਜਾਵੇ ਫਿਰ ਬੱਚਿਆਂ ਦਾ ਮਸਲਾ ਨਾ ਤੁਹਾਨੂੰ ਪਤਾ

ਠੀਕ ਹੈ ਜੀ ਠੀਕ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਹਾਂ ਅਤੇ ਅਸੀਂ ਸ਼ਾਮ ਨੂੰ ਮੈਂ ਭੇਜ ਸਕਦਾ ਆਦਮੀ ਤੁਹਾਡੇ ਕੋਲ ਲੈਣ ਲੈਣ ਵਾਸਤੇ ਠੀਕ ਹੈ ਜੀ ਉਹ ਤੁਹਾਡੇ ਕੋਲ ਪਹੁੰਚ ਜਾਣਗੇ ਕੁਝ ਗੈਸਟ ਆਏ ਆ ਇਹਨਾਂ ਨੂੰ ਵੀ ਫਿਰ ਆਉ ਭਗਤ ਹੋ ਜਾਏਗੀ ਸਾਰਿਆਂ ਦੀ ਹ ਹਾਂ ਮੈਂ ਮੇਰੇ ਖਿਆਲ 'ਚ ਵੀ ਬਾਕੀ ਮੌਕੇ 'ਤੇ ਦੱਸ ਦਿਆਂਗੇ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਤੀਹ ਤੋਂ ਉੱਪਰ ਤੀਹ ਕਿੱਲੋ ਤੋਂ ਜ਼ਿਆਦਾ ਅੱਛਾ ਚਲੋ ਉਹ ਥੋੜ੍ਹਾ ਥੋ ਠੀਕ ਹੈ ਥੋੜ੍ਹਾ ਜਿਹਾ ਪਹਿਲਾਂ ਦੱਸ ਦਿਆਂਗੇ ਪੱਕਾ ਹੈਂ ਜਿਹੜੀ ਐਗਜੈਕਟ ਫਿੱਗਰ ਹੋਊ ਉਹ ਥੋੜ੍ਹਾ ਜਿਹਾ ਪਹਿਲਾਂ ਦੱਸ ਦਾਂਗੇ ਅੰਦਾਜ਼ਾ ਅੰਦਾਜ਼ਾ ਤੁਹਾਨੂੰ ਮੈਂ ਏ ਏ ਇਹ ਦੱਸ ਦਿੱਤਾ ਅਤੇ ਪੈਸੇ ਮੈਂ ਉਹਦੇ ਲੜਕੇ ਦੇ ਹੱਥ ਹੀ ਭੇਜ ਦਿਆਂਗਾ ਹਾਂ ਵਾ ਇਹ ਤਾਂ ਇਹੀ ਹੈ ਜੀ ਕਾਰੋਬਾਰ ਕਰਨਾ ਹੀ ਹੈ ਤਾਂ ਉਹਦੇ 'ਚ ਸਫਾਈ ਸਭ ਤੋਂ ਜ਼ਰੂਰੀ ਹੈ ਹਮ ਅਤੇ ਮੈਂ ਭੇਜਾਂਗਾ ਜੀ ਠੀਕ ਹੈ ਜੀ ਫਿਰ ਓਕੇ ਸਤਿ ਸ਼੍ਰੀ ਅਕਾਲ ਜੀ